ਪੰਜਾਬ ਵਿੱਚ ਬਹੁਤ ਸਾਰੇ ਪਕਵਾਨ ਬਣਦੇ ਹਨ ਜੋ ਕਿ ਬਹੁਤ ਹੀ ਸਿਹਤਮੰਦ ਹਨ ਜਿਵੇਂ ਕਿ ਪਰੋਂਠੇ ਦਹੀਂ ਲੱਸੀ ਮੱਖਣ ਦੇਸੀ ਘਿਓ ਦਾਲ਼ ਮੱਖਣੀ ਮਟਰ ਪਨੀਰ ਸ਼ਾਹੀ ਪਨੀਰ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਮਾਂਹਾ ਦੀ ਦਾਲ਼ ਗੋਭੀ ਦੀ ਸਬਜ਼ੀ ਮਿਕਸ ਸਬਜ਼ੀ ਆਦਿ ਜਿਵੇਂ ਮੱਕੀ ਦੀ ਰੋਟੀ ਜਿਨ੍ਹਾਂ ਵਿੱਚੋਂ ਮੇਰੇ ਘਰਦਿਆਂ ਨੂੰ ਦੋ ਪਕਵਾਨ ਬਹੁਤ ਹੀ ਪਸੰਦ ਹਨ ਮੱਕੀ ਦੀ ਰੋਟੀ ਬਣਾਉਣ ਲਈ ਸਾਨੂੰ ਮਕ ਅਟ ਪਹਿਲਾਂ ਆਟਾ ਲਓ ਆਟੇ ਵਿੱਚ ਨਮਕ ਹਰੀ ਮਿਰਚ ਪਿਆਜ਼ ਪਾਓ ਅਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਓ ਉਸ ਤੋਂ ਬਾਅਦ ਪੇੜਾ ਬਣਾ ਲਓ ਪੇੜਾ ਬਣਾ ਕੇ ਉਸਨੂੰ ਤਵੇ 'ਤੇ ਪਾ ਦਿਉ ਅਤੇ ਉਸ 'ਤੇ ਦੇਸੀ ਘੀ ਲਗਾ ਕੇ ਚੰਗੀ ਤਰ੍ਹਾਂ ਸੇਕ ਲਓ ਅਤੇ ਬਹੁਤ ਵਧੀਆ ਮੇਥਿਆਂ ਵਾਲ਼ੀ ਮੱਕੀ ਦੀ ਰੋਟੀ ਬਣਦੀ ਹੈ ਉਸ ਤੋਂ ਬਾਅਦ ਪਨੀਰ ਦੀ ਸਬਜ਼ੀ ਪਨੀਰ ਦੀ ਸਬਜ਼ੀ ਜਿਵੇਂ ਸਭ ਤੋਂ ਪਹਿਲਾਂ ਕੜਾਹੀ ਵਿੱਚ ਤੇਲ ਪਾਓ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਅਤੇ ਉਸ ਤੋਂ ਬਾਅਦ ਤੁਸੀਂ ਜੀਰਾ ਪਾਓ ਜੀਰੇ ਤੋਂ ਬਾਅਦ ਉਸ ਵਿੱਚ ਪਿਆਜ਼ ਪਾ ਦਿਓ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਸੇਕ ਕੇ ਉਸ ਵਿੱਚ ਚ ਟਮਾਟਰ ਪਾ ਦਿਓ ਉਸ ਤੋਂ ਬਾਅਦ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨ ਕੇ ਉਸ ਵਿੱਚ ਲੂਣ ਮਿਰਚ ਮਸਾਲਾ ਹਲਦੀ ਨਮਕ ਪਾ ਕੇ ਉਸਨੂੰ ਚੰਗੀ ਤਰ੍ਹਾਂ ਸੇਕ ਲਗਾ ਲਓ ਅਤੇ ਉਸ ਵਿੱਚ ਉਸ ਤੋਂ ਬਾਅਦ ਉਸ ਵਿੱਚ ਮਟਰ ਪਾ ਦਿਓ ਮਟਰਾਂ ਨੂੰ ਚੰਗੀ ਤਰ੍ਹਾਂ ਸੇਕ ਲਗਵਾ ਕੇ ਉਸ ਵਿੱਚ ਥੋੜ੍ਹਾ ਗਰਮ ਪਾਣੀ ਪਾ ਦਿਓ ਅਤੇ ਚੰਗੀ ਤਰ੍ਹਾਂ ਸੇਕ ਲਵਾ ਲਓ ਅਤੇ ਉਸ ਵਿੱਚ ਉਸ ਤੋਂ ਬਾਅਦ ਉਸ ਵਿੱਚ ਪਨੀਰ ਪਾ ਦਿਓ ਉਸ ਤੋਂ ਬਾਅਦ ਪਨੀਰ ਬਣ ਚੰਗੀ ਤਰ੍ਹਾਂ ਬਣ ਜਾਂਦਾ ਹੈ